ਭੰਗੜਾ ਪੰਜਾਬ ਵਿੱਚ ਕਾਫ਼ੀ ਮਸ਼ਹੂਰ ਹੈ ਅਤੇ ਇਹ ਮੈਂ ਕੁਛ ਦਿਨ ਪਹਿਲੇ ਇੱਕ ਮੇਲੇ ਵਿੱਚ ਗਿਆ ਸੀ ਜਿੱਥੇ ਮੈਂ ਕੁਛ ਨੌਜਵਾਨਾਂ ਨੂੰ ਭੰਗੜਾ ਪਾਉਂਦੇ ਹੋਏ ਵੇਖਿਆ ਭੰਗੜੇ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਨੱਚਦੀਆਂ ਹਨ ਕਈ ਵਾਰ ਸਿੰਗਲ ਪ੍ਰਫੋਰਮੈਂਸ ਵੀ ਕਰਦੇ ਨੇ ਅਤੇ ਇਨ੍ਹਾਂ ਦੇ ਅਲੱਗ ਅਲੱਗ ਪ੍ਰਕਾਰ ਦੇ ਕੱਪੜੇ ਪਾਏ ਹੁੰਦੇ ਨੇ ਕਿਸੇ ਨੇ ਹਰੇ ਪਾਏ ਹੁੰਦੇ ਨੇ ਕਿਸੇ ਨੇ ਨੀਲੇ ਪਾਏ ਹੁੰਦੇ ਨੇ ਕਿਸੇ ਨੇ ਲਾਲ ਪਾਏ ਹੁੰਦੇ ਨੇ ਅਤੇ ਨੌਜਵਾਨਾਂ ਨੂੰ ਜਦ ਅਸੀਂ ਵੇਖਦੇ ਹਾਂ ਕਿ ਇੰਨੀ ਐਨਰਜੀ ਨਾਲ ਉਹ ਡਾਂਸ ਕਰ ਰਹੇ ਨੇ ਭੰਗੜਾ ਪਾ ਰਹੇ ਨੇ ਉਨ੍ਹਾਂ ਨੂੰ ਵੇਖ ਕੇ ਸਾਡਾ ਮਨ ਵੀ ਕਰਦਾ ਕਿ ਅਸੀਂ ਭੰਗੜਾ ਕਰੀਏ ਉਨ੍ਹਾਂ ਨਾਲ ਇੰਜੋਏ ਕੀਜੀਏ ਕਰੀਏ ਅਤੇ ਭੰਗੜਾ ਸਾਡੇ ਪੰਜਾਬ ਦਾ ਇਹ ਇੰਪੋਟੈਂਟ ਡਾਂਸ ਹੈਗਾ ਇਹ ਸਾਨੂੰ ਵੀ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਅੱਜ ਕੱਲ੍ਹ ਮੈਂ ਸਾਡੇ ਕੋਲੇਜ ਅੰਦਰ ਫ਼ੰਕਸ਼ਨ ਹੁੰਦੇ ਨੇ ਉੱਥੇ ਵੀ ਕੁਛ ਦਿਨ ਪਹਿਲੇ ਮੈਂ ਬੱਚਿਆਂ ਨੂੰ ਭੰਗੜਾ ਪਾਉਂਦੇ ਹੋਏ ਵੇਖਿਆ ਸੀ ਅਤੇ ਉਹ ਕਾਫ਼ੀ ਅੱਛਾ ਡਾਂਸ ਕੀਤਾ ਸੀ ਉਨ੍ਹਾਂ ਨੂੰ ਸਾਰੇ ਟੀਚਰਾਂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ ਉਨ੍ਹਾਂ ਨੂੰ ਪ੍ਰਾਈਜ਼ ਵੀ ਮਿਲਿਆ ਸੀ ਅਤੇ ਸਾਨੂੰ ਵੀ ਇਹ ਚਾਹੀਦਾ ਅਸੀਂ ਵੀ ਭੰਗੜੇ ਅੰਦਰ ਇਸ ਲਈ ਪੰਜਾਬ ਦੇ ਸੱਭਿਆਚਾਰ ਵਿੱਚ ਪ ਭੰਗੜੇ ਦਾ ਬਹੁਤ ਵੱਡਾ ਯੋਗਦਾਨ ਹੈਗਾ ਹੈ ਅਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਭੰਗੜੇ ਨੂੰ ਇਵੇਂ ਹੀ ਆਪਣੇ ਸੱਭਿਆਚਾਰ ਦਾ ਹਿੱਸਾ ਬਣਾਈ ਰੱਖੀਏ ਅਤੇ ਉਹਨੂੰ ਪੂਰੇ ਜ਼ੋਰ ਸ਼ੋਰ ਨਾਲ ਅਸੀਂ ਸੈਲੀਬ੍ਰੇਟ ਕਰੀਏ ਅਤੇ ਬਹੁਤ ਜ਼ਰੂਰੀ ਹੈ ਅਸੀਂ ਇਹਦਾ ਯੋਗਦਾਨ ਪੂਰਾ ਅਸੀਂ ਆਪਣੀ ਇਸ ਕਲਚਰ ਦੇ ਅੰਦਰ ਰੱਖੀਏ